ਅੱਜ ਭਾਰਤ ਦੇ ਸਾਹਮਣੇ ਵਾਤਾਵਰਨ ਸਬੰਧੀ ਵੱਡੇ ਮੁੱਦੇ ਸਭ ਤੋਂ ਵੱਡਾ ਮੇਨ ਮੁੱਦਾ ਦਰੱਖਤਾਂ ਦਾ ਜੋ ਕਿ ਦਰੱਖਤ ਵੱਢੇ ਜਾਂਦੇ ਨੇ ਦਰੱਖਤ ਵੱਢਣ ਦੇ ਨਾਲ ਜਿਹੜੀ ਮਿੱਟੀ ਆ ਬਹੁਤ ਖੁਰ ਰਹੀ ਹੈ ਮਿੱਟੀ ਖੁਰਨ ਦੇ ਨਾਲ ਹੜ੍ਹ ਸੁਨਾਮੀ ਆਉਂਦੀਆਂ ਨੇ ਦਰੱਖਤ ਕੱਟਣ ਦੇ ਨਾਲ ਪੰਛੀ ਘਰਾਂ ਤੋਂ ਬੇਘਰ ਹੋ ਰਹੇ ਨੇ ਉਹਨਾਂ ਨੂੰ ਆਪਣੇ ਆਲ੍ਹਣੇ ਬਣਾਉਣ ਲਈ ਘਰ ਬਣਾਉਣ ਲਈ ਜਗ੍ਹਾ ਨਹੀਂ ਮਿਲ ਰਹੀ ਅਤੇ ਹੋਰ ਵੀ ਜਿਹੜੇ ਆਪਣੇ ਰਸਤੇ ਦੇ ਵਿੱਚ ਸਮੁੰਦਰ ਨੇ ਨਦੀਆਂ ਨੇ ਜਾਂ ਨਾਲੇ ਨੇ ਉਹਨਾਂ ਨੂੰ ਬੰਦ ਕਰ ਤ ਕੀਤਾ ਜਾਂਦਾ ਜਾਂ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਸੜਕ ਬਣਾਈ ਜਾਂਦੀ ਹੈ ਜੋ ਕਿ ਸੜਕਾਂ ਹੈ ਤਾਂ ਫਾਇਦੇ ਲਈ ਪਰ ਇਹ ਫਿਰ ਰਸਤਾ ਜਦੋਂ ਬਦਲਿਆ ਜਾਂਦਾ ਤਾਂ ਹੜ੍ਹਾਂ ਦਾ ਸੁਨਾਮੀਆਂ ਦਾ ਕਾਰਨ ਬਣਦੀਆਂ ਨੇ ਜਣੀ ਜੰਗਲ ਵੀ ਕੱਟੇ ਗਏ ਨੇ ਜਿਨਾਂ ਵਿੱਚੋਂ ਜਾਨਵਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਦਰੱਖਤ ਕੱਟਣ ਦੇ ਨਾਲ ਸਾਡਾ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਇਆ